ਇੱਕ ਕਲਾਕਾਰ ਦੇ ਰੂਪ ਵਿੱਚ ਮੈਨੂੰ ਕਾਫੀ ਜ਼ਿਆਦਾ ਦਿੱਕਤਾਂ ਆਉਂਦੀਆਂ ਹਨ ਜਿਵੇਂ ਇੱਕ ਚਰਿੱਤਰ ਬਣਾਉਣ ਵਾਸਤੇ ਇੱਕ ਸ ਸ਼ਾਂਤ ਮਾਹੌਲ ਦਾ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਈ ਵਾਰ ਘਰ ਵਿੱਚ ਇਹੋ ਜਿਹਾ ਮਾਹੌਲ ਮਿਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜਿਸ ਵਿਚ ਚਰਿ ਜਿਸ ਕਾਰਨ ਚਰਿੱਤਰ ਬਣਾਉਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਦੂਸਰਾ ਚਰਿੱਤਰ ਬਣਾਉਣ ਵਾਸਤੇ ਸਾਨੂੰ ਕਾਫੀ ਜ਼ਿਆਦਾ ਸਮਾਨ ਦੀ ਜ਼ਰੂਰਤ ਪੈਂਦੀ ਹੈ ਸਟੇ ਕੁਛ ਕਈ ਵਾਰ ਇਹੋ ਜਿਹੇ ਸਮਾਨ ਦੀ ਜ਼ਰੂਰਤ ਪੈ ਜਾਂਦੀ ਹੈ ਜੋ ਸਾਨੂੰ ਨੇੜੇ ਤੇੜੇ ਨਹੀਂ ਮਿਲਦਾ ਜਿਸ ਲਈ ਸਾਨੂੰ ਕਾਫੀ ਦੂਰ ਜਾਣਾ ਪੈਂਦਾ ਹੈ ਇਸ ਵਿਚ ਸਾਡਾ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈ ਅਤੇ ਆਹਾ ਇਹ ਸਟੇਸ਼ਨਰੀ ਦਾ ਸਮਾਨ ਕਾਫੀ ਮਹਿੰਗਾ ਆਉਂਦਾ ਹੈ ਜਿਸ ਨੂੰ ਕਈ ਵਾਰੀ ਖਰੀਦ ਪਾਉਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ ਕੁਛ ਕੁਛ ਕ ਆਪਣੀਆਂ ਕਲਾ ਨੂੰ ਥੋੜ੍ਹਾ ਸੁਧਾਰਨ ਵਾਸਤੇ ਕੁਛ ਟੈਕਨੀਕਸ ਦੀਆਂ ਇਸਤੇਮਾਲ ਵੀ ਕਰਨਾ ਪੈਂਦਾ ਹੈ ਜਿਸ ਨੂੰ ਸਿੱਖਣ ਲਈ ਨੇੜੇ ਤੇੜੇ ਕੋਈ ਟੀਚਰ ਵੀ ਨਹੀਂ ਮਿਲਦਾ ਪਰ ਮੈਂ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਮੈਂ ਔਨਲਾਈਨ ਯੂਟਿਊਬ ਵਗੈਰਾ ਤੋਂ ਵੀਡੀਓਜ਼ ਵਗੈਰਾ ਦੇਖ ਲੈਂਦੀ ਹਾਂ ਜਿਸ ਨਾਲ ਮੇਰੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆ ਹਨ ਅਤੇ ਮੈਂ ਆਪਣੀ ਕਲਾ ਉੱਤੇ ਥੋੜ੍ਹਾ ਜਿਹਾ ਫੋਕਸ ਕਰ ਪਾਉਂਦੀ ਹਾਂ